ਛੇ ਅਗਸਤ ਉੱਨੀ ਸੋ ਉਣਾਨਵੇਂ ਦਸ ਅਕਤੂਬਰ ਦੋ ਹਜਾਰ ਵੀਹ ਦੋ ਅਪ੍ਰੈਲ ਦੋ ਹਜਾਰ ਇੱਕੀ ਪੰਜ ਸਤੰਬਰ ਉਨੀ ਸੋ ਅਠਾਸੀ ਤਿੰਨ ਨਵੰਬਰ ਉੱਨੀ ਸੋ ਇਕਾਨਵੇਂ